ਅਸੀਂ ਵਿਆਹਾਂ ਵਿੱਚ ਜਿਹੜਾ ਅਨੰਦ ਹੈ ਉਹ ਮਤਲਬ ਮੰਨ ਲਈਏ ਆਪਾਂ ਅੱਛਾ ਉੱਥੇ ਖਾਣਾ ਪੀਣਾ ਹੁੰਦਾ ਹੈ ਉਹ ਖਾ ਪੀ ਕੇ ਅਤੇ ਜਿਹੜੇ ਆਪਣੇ ਰਿਸ਼ਤੇਦਾਰ ਜਾਂ ਮਤਲਬ ਯਾਰ ਦੋਸਤ ਆਏ ਹੁੰਦੇ ਆ ਉਨ੍ਹਾਂ ਨਾਲ ਆਪਾਂ ਵਧੀਆ ਇੰਜੋਏ ਕਰਦੇ ਹਾਂ ਸਾਰਾ ਜਿਹੜਾ ਵੀ ਉੱਥੇ ਮਾਹੌਲ ਹੁੰਦਾ ਅਤੇ ਸਭ ਤੋਂ ਜਿਹੜੀ ਮੇਨ ਗੱਲ ਹੁੰਦੀ ਹੈ ਨੱਚਣਾ ਟੱਪਣਾ ਆਪਾਂ ਮਤਲਬ ਖੁੱਲ੍ਹੇ ਦਿਮਾਗ ਨਾਲ ਉੱਥੇ ਨੱਚ ਟੱਪ ਸਕਦੇ ਹਾਂ ਆਪਣੇ ਜਿਹੜੇ ਖਾਸ ਲੋਕ ਹੁੰਦੇ ਆ ਉਨ੍ਹਾਂ ਦੇ ਵਿੱਚ ਅਤੇ ਉਸ ਟਾਈਮ 'ਤੇ ਨੱਚਣ ਗਾਉਣ ਦਾ ਬੜਾ ਅੱਛਾ ਮਾਹੌਲ ਬਣ ਰਿਹਾ ਹੁੰਦਾ ਖੁਸ਼ੀ ਹੁੰਦੀ ਹੈ ਖੁਸ਼ੀ 'ਚ ਸਾਰੇ ਨੱਚ ਰਹੇ ਹੁੰਦੇ ਹੈ ਕੋਈ ਮਤਲਬ ਐਦਾਂ ਟੈਨਸ਼ਨ ਨਹੀਂ ਹੁੰਦੀ ਕਿ ਆਪਾਂ ਪਰਟੀਕੁਲਰ ਕੋਈ ਇੱਕ ਸਟੈਪ ਬਣਾਉਣਾ ਜਾਂ ਕੁਛ ਆਪਾਂ ਆਪਣੇ ਮਤਲਬ ਮਨ 'ਚ ਜਿਵੇਂ ਵੀ ਆਪਾਂ ਫੀਲ ਕਰ ਰਹੇ ਹਾਂ ਉਵੇਂ ਆਪਾਂ ਨੱਚ ਰਹੇ ਹੁੰਦੇ ਹਾਂ ਵਿਆਹ ਸ਼ਾਦੀਆਂ 'ਚ ਕਿਉਂਕਿ ਉਸ ਟਾਈਮ ਮਾਹੌਲ ਹੀ ਐਨਾ ਵਧੀਆ ਹੁੰਦਾ ਮਤਲਬ ਸਾਰੇ ਮਤਲਬ ਖੁਸ਼ ਹੋ ਰਹੇ ਹੁੰਦੇ ਆ ਅਤੇ ਇਸ ਕਰਕੇ ਜਿਹੜੇ ਡ ਨੱਚਣਾ ਗਾਉਣਾ ਹੀ ਮੇਨ ਆਪਾਂ ਮਤਲਬ ਐਵੇਂ ਕਹਿ ਦਿੰਦੇ ਹਾਂ ਕਿ ਵਿਆਹ ਸ਼ਾਦੀਆਂ 'ਚ ਨੱਚ ਗਾ ਕੇ ਹੀ ਆਪਾਂ ਅਨੰਦ ਮਾਣਦੇ ਹਾਂ ਅਤੇ ਇਹਦੇ ਲਈ ਮਤਲਬ ਬੜੇ ਅੱਛੇ ਗਾਣੇ ਵੀ ਬਣੇ ਹੋਏ ਹੈ ਨੱਚਣ ਵਗੈਰਾ ਦੇ ਲਈ ਅਤੇ ਉਸ ਟਾਈਮ ਮਿਊਜਿਕ ਵੀ ਬੜਾ ਲਾਊਡ ਅਤੇ ਬੜਾ ਅੱਛਾ ਵੱਜ ਰਿਹਾ ਹੁੰਦਾ ਡੀ ਜੇ ਵਗੈਰਾ 'ਤੇ ਅਤੇ ਇਹਦੇ ਲਈ ਜਿਹੜੇ ਸਪੈਸ਼ਲ ਗਾਣੇ ਹੁੰਦੇ ਹੈ ਉਹ ਗਾਣੇ ਚੱਲ ਰਹੇ ਹੁੰਦੇ ਹੈ ਨੱਚਣ ਵਾਸਤੇ ਕੁਛ ਮਤਲਬ ਮੰਨ ਲਉ ਕਿ ਨਵੇਂ ਵਿਆਹ ਨਵੇਂ ਵਿਆਹ ਵਾਲੇ ਜੋੜੇ ਦੇ ਲਈ ਕੁਛ ਐਕਸਟਰਾ ਕੁਛ ਸੋਂਗ ਵਜਾ ਕੇ ਜਾਂ ਘਰ ਦਾ ਮਤਲਬ ਦੁੱਲੇ ਦੇ ਜਿਹੜੇ ਯਾਰ ਦੋਸਤ ਹੈ ਉਹ ਕੁਛ ਇਸ ਤਰ੍ਹਾਂ ਦਾ ਡੈਡੀਕੇਟ ਕਰਦੇ ਹੈ ਆਪਦੇ ਜਿਹੜਾ ਉਨ੍ਹਾਂ ਦਾ ਫਰੈਂਡ ਦੁੱਲਾ ਜਿਹੜੀ ਜਿਹਦੀ ਮੈਰਿਜ ਹੋ ਰਹੀ ਹੁੰਦੀ ਹੈ ਉਹਨੂੰ ਕੁਛ ਐਕਸਟਰਾ ਮਤਲਬ ਪ੍ਰਫੋਰਮੈਂਸ ਦੇ ਕੇ ਅਤੇ ਘ ਮਤਲਬ ਜਿਹੜੀ ਘਰ ਦੀ ਲੜਕੀਆਂ ਉਨ੍ਹਾਂ ਲਈ ਵੀ ਬੜੇ ਬੱ ਅੱਛੇ ਗਾਣੇ ਬਣੇ ਹੋਏ ਹੈ ਫ਼ਿਲਮਾਂ ਦੇ ਜਿਨ੍ਹਾਂ ਨਾਲ ਆਪਾਂ ਆਪਣੇ ਮਤਲਬ ਜਿਹੜੇ ਮਨ ਦੇ ਭਾਵ ਹੈ ਉਨ੍ਹਾਂ ਨੂੰ ਪ੍ਰਗਟ ਕਰ ਸਕਦੇ ਹਾਂ ਨੱਚ ਕੇ ਗਾ ਕੇ ਬਹੁਤ ਅੱਛੇ ਅੱਛੇ ਗਾਣੇ ਇਸ ਤਰ੍ਹਾਂ ਦੇ ਬਣੇ ਹੋਏ ਹੈ ਬੜੀ ਅੱਛੀ ਰਿਧਮ ਵਾਲੇ ਬੜੇ ਅੱਛੇ ਮਿਊਜਿਕ ਵਾਲੇ ਜਿਨ੍ਹਾਂ ਨੂੰ ਸੁਣਕੇ ਆਪੇ ਹੀ ਪੈਰ ਉੱਠਣ ਲੱਗ ਜਾਂਦਾ ਆਪੇ ਹੀ ਆਪਣਾ ਜਿਹੜਾ ਮਨ ਹੈ ਉਹ ਥਿੜਕਣ ਨੂੰ ਕਰਨ ਲੱਗ ਜਾਂਦਾ